ਹਾਂ ਜੀ ਅਸੀਂ ਤੁਹਾਡੇ ਤੋਂ ਆਨਲਾਈਨ ਜੁੱਤੀਆਂ ਖਰੀਦੀਆਂ ਸੀ ਉਹ ਇੱਕ ਵਾਰ ਪਾਏ 'ਚ ਹੀ ਖਰਾਬ ਹੋ ਗਈਆਂ ਨੇ ਅਸੀਂ ਇਹ ਜੁੱਤੀਆਂ ਵਾਪਸ ਕਰਨਾ ਚਾਹੁੰਦੇ ਹਾਂ ਕਿਰਪਾ ਕਰਕੇ ਤੁਸੀਂ ਆਪਦੇ ਡਿਲੀਵਰੀ ਬੋਏ ਨੂੰ ਭੇਜ ਕੇ ਇਹ ਜੁੱਤੀਆਂ ਵਾਪਸ ਲੈ ਜਾਓ ਅਤੇ ਸਾਨੂੰ ਹੋਰ ਸਟੋਕ ਦੀ ਖੇਚਲ ਕਰੋ ਤਾਂ ਜੋ ਅਸੀਂ ਇਹਨਾਂ ਜੁੱਤੀਆਂ ਦੇ ਬਦਲੇ ਕੁਛ ਹੋਰ ਲੈ ਸਕੀਏ